ਭੰਗੜਾ ਐਰੋਬਿਕਸ ਪੰਜਾਬ ਦੇ ਸਭਿਆਚਾਰਕ ਵਿਰਸੇ ਨੂੰ ਬਹੁਤ ਖੂਬਸੂਰਤੀ ਨਾਲ ਦਰਸਾਉਂਦਾ ਹੈ ਭੰਗੜਾ ਪੰਜਾਬੀ ਲੋਕ ਨਾਚ ਹੈ ਇਸ ਨਾਲ ਖੁਸ਼ੀ ਉਤਸ਼ਾਹ ਅਤੇ ਜਸ਼ਨ ਦਾ ਅਹਿਸਾਸ ਹੁੰਦਾ ਹੈ ਹਰ ਖੁਸ਼ੀ ਦੇ ਮੌਕੇ 'ਤੇ ਅਸੀਂ ਭੰਗੜਾ ਐਰੋਬਿਕਸ ਕਰ ਸਕਦੇ ਹਾਂ ਭੰਗੜਾ ਐਰੋਬਿਕਸ ਸਿੱਖਣ ਵਾਲੇ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਨ ਦਾ ਮੌਕਾ ਵੀ ਮਿਲਦਾ ਹੈ ਤਿਉਹਾਰ ਅਤੇ ਖੁਸ਼ੀ ਦੇ ਮੌਕੇ 'ਤੇ ਮੌਜ ਮਸਤੀ ਕਰ ਸਕਦੇ ਹਾਂ ਸੰਗੀਤ ਨੂੰ ਵਧੀਆ ਬਣਾ ਸਕਦੇ ਹਾਂ ਇਹ ਸਿਰਫ ਸਿਹਤ ਲਈ ਹੀ ਨਹੀਂ ਫਾਇਦੇਮੰਦ ਸਗੋਂ ਪੰਜਾਬੀ ਵਿਰਸੇ ਦੀ ਪਹਿਚਾਣ ਵੀ ਕਰਦਾ ਹੈ ਇਸ ਰਿਦਮ ਨਾਲ ਕਸਰਤ ਵੀ ਕਰ ਸਕਦੇ ਹਾਂ ਭੰਗੜਾ ਐਰੋਬਿਕਸ ਦੇ ਰਿਦਮ ਨਾਲ ਕਸਰਤ ਅਤੇ ਵਰਕਆਊਟ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਆਪਣੇ ਸਰੀਰ ਨੂੰ ਉਤਸ਼ਾਹ ਵੀ ਮਿਲਦਾ ਹੈ